ਅਸੀਂ ਸਰੀਰ ਦੀ ਲਚਕਤਾ ਨੂੰ ਵਧਾਉਣ ਲਈ ਗਊ ਮੁਖ ਆਸਨ ਕਰ ਸਕਦੇ ਹਾਂ ਗਊਮੁਖ ਆਸਨ ਕਰਨ ਨਾਲ ਦੇ ਬਾਹਵਾਂ ਜਦੋਂ ਪਿੱਛੇ ਤੱਕ ਇੱਕ ਦੂਸਰੇ ਨੂੰ ਮਿਲ ਬਾਂਹ ਪਿੱਛੇ ਲਜਾ ਕੇ ਕਮਰ ਦੇ ਕੁੱਲ ਬ ਮਿਲਾਉਂਦੇ ਹਾਂ ਤਾਂ ਬਾਹਵਾਂ ਦੇ ਵਿੱਚ ਲਚਕ ਆਉਂਦੀ ਹੈ ਔਰ ਇਕ ਗੋਡ ਇੱਕ ਸਿਰ ਤੋਂ ਲੈ ਕੇ ਅਨ ਗੋਡ ਗੋਡਿਆਂ ਤੱਕ ਦਾ ਆਸਨ ਹੈ ਉਸਨੂੰ ਪੂਰੇ ਸਿਰ ਸਿਰ ਨੂੰ ਗੋਡਿਆਂ ਤੱਕ ਖੜੇ ਹੋ ਕੇ ਸਿਰ ਨੂੰ ਗੋਡਿਆਂ ਤੱਕ ਲਿਜਾਂਦੇ ਹਾਂ ਤਾਂ ਇਸ 'ਤੇ ਬਿਨ ਨਾਲ ਵੀ ਆਸ ਸਰੀਰ ਵਿੱਚ ਵੀ ਲਚਕਤਾ ਆਉਂਦੀ ਹੈ ਸਰੀਰ ਵਿੱਚ ਲੱਚਕਤਾ ਲਿਉਣ ਲਿਆਉਣ ਨਾਲ ਸਾਡੇ ਸਰੀਰ ਸਾਨੂੰ ਚੁਸਤੀ ਅਤੇ ਦਰੁਸਤੀ ਆਉਂਦੀ ਹੈ ਸਾਡੇ ਸਰੀਰ ਵਿੱਚ ਆਲਸ ਤਿਆਰ ਨਹੀਂ ਰਹਿੰਦਾ ਸਰੀਰ ਜਿੰਨਾ ਵੀ ਲਚਕ ਸ਼ ਲਚਕੀਲਾ ਹੋਵੇਗਾ ਉੰਨਾ ਹੀ ਸਾਨੂੰ ਸ਼ ਕੰਮ ਕੁੰਮ ਕਰਨ ਵਿੱਚ ਬੜੀ ਆਸਾਨੀ ਹੋਵੇਗੀ ਸਰੀਰ ਨੂੰ ਕਿਸੇ ਵੀ ਤਰੀਕੇ ਨਾਲ ਘੁਮਾ ਸਕਦੇ ਹਾਂ ਅਗਰ ਯੋਗਾ ਕਰਨ ਵਿੱਚ ਅਲਗ ਅਲਗ ਆਸਨਾਂ ਦੇ ਨਾਲ ਜਦੋਂ ਅਸੀਂ ਸਰੀਰ ਨੂੰ ਇੱਕ ਦੂਜੇ ਇੱਧਰੋਂ ਉਧਰੋਂ ਹਿਲਾਉਂਦੇ ਹਾਂ ਤਾਂ ਸਰੀਰ ਦੀ ਲਚਕ ਵੱਧ ਜਾਂਦੀ ਹੈ ਸਰੀਰ ਦੀ ਲੱਚਕ ਆਉਣ ਦੇ ਨਾਲ ਸਾਡੇ ਸਰੀਰ ਵਿੱਚ ਸਭ ਕੁਛ ਫਟਾਫਟ ਹੁੰਦਾ ਹੈ ਕੋਈ ਬੈਠ ਬੈਠ ਕੇ ਅਸੀਂ ਕੋਈ ਵੀ ਆਸਨ ਕਰਦਾ ਕਰਨਾ ਹੁੰਦਾ ਹੈ ਤਾਂ ਬਾਹਵਾਂ ਲੱਤਾਂ ਆਸਾਨੀ ਨਾਲ ਅੱਗੇ ਪਿੱਛੇ ਹੋ ਜਾਂਦੀਆਂ ਹਨ ਇਸ ਲਈ ਅਤੇ ਅਸ ਕਈ ਤਰ੍ਹਾਂ ਦੇ ਆਸਨ ਦੱਸੇ ਗਏ ਹਨ ਲੇਕਿਨ ਪ੍ਰਮੁੱਖ ਆਸਨ ਇਹ ਹੀ ਹੈ ਗਊਮਖ ਆਸਨ ਹੈ ਗਊਮੁਖ ਆਸਨ ਦੇ ਨਾਲ ਮੋਢੇ ਬਾਹਵਾਂ ਔਰ ਸ਼ ਦਿਮਾਗ ਦੂ ਲਚਕ ਆਉਂਦੀ ਹੈ ਆ ਅਤੇ ਜਿਹੜਾ ਸਿਰ ਤੋਂ ਲੈ ਕੇ ਗੋਡੇ ਤੱਕ ਦਾ ਆਸਨ ਹੈ ਇਸ ਦੇ ਨਾਲ ਪਿੱਠ ਦੇ ਵਿੱਚ ਲਚਕ ਆਉਂਦੀ ਹੈ ਧੰਨਵਾਦ